ਦੇਖੋ ਮੈਨੂੰ ਲੱਗਦਾ ਹੈ ਕਿ ਹੋਰ ਗ੍ਰਹਿ 'ਤੇ ਜੀਵਨ ਹੈ ਕਿਉਂਕਿ ਜਿਵੇਂ ਅਸੀਂ ਹੁਣ ਕਈ ਵਾਰੀ ਅਮਰੀਕਾ ਤੋਂ ਆਰਟੀਕਲ ਜਿਹੜੇ ਆਉਂਦੇ ਨੇ ਆਪਾਂ ਉਹ ਪੜ੍ਹਦੇ ਰਹਿੰਦੇ ਹਾਂ ਤਾਂ ਉਹਨਾਂ 'ਚ ਪਤਾ ਲੱਗਦਾ ਹੈ ਕਿ ਜਿਵੇਂ ਓਹ ਮਾਰਸ 'ਤੇ ਵੀ ਹੁਣ ਪਹੁੰਚ ਚੁੱਕੇ ਨੇ ਅਮਰੀਕਾ ਵਾਲੇ ਅਤੇ ਉੱਥੇ ਉਹ ਦੱਸਦੇ ਨੇ ਕਿ ਉੱਥੇ ਦਾ ਤਾਪਮਾਨ ਕਿਵੇਂ ਜਿਹਾ ਉੱਥੋਂ ਦਾ ਮੌਸਮ ਕਿਵੇਂ ਜਿਹਾ ਹੈ ਆਪਾਂ ਬਾਕੀ ਜੇ ਚੰਦ ਦੀ ਵੀ ਗੱਲ ਕਰੀਏ ਜੀ ਹੁਣ ਤਾਂ ਚੰਦ 'ਤੇ ਵੀ ਸਾਡਾ ਭਾਰਤ ਪਹੁੰਚ ਗਿਆ ਜੀ ਅਤੇ ਬਾਕੀ ਗ੍ਰਹਿਆਂ 'ਤੇ ਜੀਵਨ ਹੈ ਜੀ ਕਿਉਂਕਿ ਦੁਨੀਆਂ ਜਿਹੜੀ ਆਪਣਾ ਇਹ ਇੱਕ ਗਲੋਬ ਨਹੀਂ ਹੈਗਾ ਜੀ ਕਹਿੰਦੇ ਹਾਂ ਆਪਾਂ ਕਿ ਬਹੁਤ ਜ਼ਿਆਦਾ ਗਲੋਬ ਨੇ ਤਾਂ ਹਾਲੇ ਹੋ ਸਕਦਾ ਆਪਾਂ ਇੰਨੀ ਰੀਸਰਚ ਨਹੀਂ ਕੀਤੀ ਆਪਾਂ ਉੱਥੇ ਤੱਕ ਨਹੀਂ ਪਹੁੰਚੇ ਕਿ ਆਪਾਂ ਨੂੰ ਪਤਾ ਲੱਗ ਸਕੇ ਪਰ ਹਾਲੇ ਤਾਂ ਮੈਂ ਮੰਨਦਾ ਕੀ ਹੈ ਕਿਉਂਕਿ ਜਿਹੜੇ ਵੀ ਆਪਾਂ ਅਖਬਾਰ 'ਚ ਵੀ ਕਈ ਵਾਰੀ ਆਰਟੀਕਲ ਆਉਂਦੇ ਨੇ ਕਿ ਕਿ ਇੱਕ ਯੂ ਐੱਫ ਓ ਹਵਾ 'ਚ ਦਿਖਿਆ ਜੀ ਜਾਂ ਕੁਛ ਦਿਖਿਆ ਹੁਣ ਕੁਛ ਤਾਂ ਸੱਚ ਹੋਵੇਗਾ ਜੀ ਉਨ੍ਹਾਂ 'ਚ ਇੰਨਾਂ ਵੱਡਾ ਜਿਹੜਾ ਆਪਾਂ ਕਹਿ ਦਿੰਦੇ ਹਾਂ ਗਲੈਕਸੀ ਹੈ ਆਪਣੀ ਇੱਕ ਗਲੈਕਸੀ ਆ ਮਿਲਕੀ ਵੇ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਹੀ ਗਲੈਕਸੀਆਂ ਨੇ ਜਿਹ ਤੋਂ ਉੱਥੇ ਮੈਨੂੰ ਲੱਗਦਾ ਹੈ ਕਿ ਜੀਵਨ ਹੋਵੇਗਾ ਕਿਸੇ ਨਾ ਕਿਤੇ ਤਾਂ ਆਪਣੇ ਵਰਗੇ ਲੋਕ ਜਿਹੜੇ ਆਪਣੇ ਵਾਂਗ ਹੀ ਰਹਿੰਦੇ ਹੋਣੇ ਆ ਆਪਣੇ ਵਰਗੇ ਕੱਪੜੇ ਪਾਉਂਦੇ ਹੋਣੇ ਸਾਰਾ ਕੁਝ ਹੋਵੇਗਾ ਇਹੀ ਏਲੀਅਨ ਹੋ ਸਕਦੇ ਨੇ ਜੀ ਜਿਹੜੇ ਆਪਣੇ ਤੋਂ ਬਹੁਤ ਐਡਵਾਂਸ ਹੋਣ ਉਹਨਾਂ ਦੀ ਟੈਕਨੋਲੋਜੀ ਬੜੀ ਉੱਪਰ ਹੋਵੇ ਆਪਣੇ ਤੋਂ ਕੁਛ ਵੀ ਹੋ ਸਕਦਾ ਜਿੱਦਾਂ ਮੈਨੂੰ ਲੱਗਦਾ ਹੈਗਾ ਜੀ